ਪੰਜਾਬੀ ਭਾਸ਼ਾ ਸਾਡੀ ਮਾਤਰ ਭਾਸ਼ਾ ਹੈ ਅਤੇ ਇਸ ਭਾਸ਼ਾ ਨੂੰ ਸੁਰੱਖਿਅਤ ਰੱਖਣ ਲਈ ਆਪਾਂ ਬਹੁਤ ਯਤਨ ਕਰ ਰਹੇ ਹਾਂ ਕ ਜਿਵੇਂ ਆਪਾਂ ਦੇਖਦੇ ਹਾਂ ਕਿ ਅੱਜ ਕੱਲ੍ਹ ਦੇ ਸਾਡੇ ਪੰਜਾਬੀ ਗਾਇਕ ਅਤੇ ਸਾਡੇ ਗੀ ਗੀਤਕਾਰ ਅਤੇ ਸਾਡੇ ਫੇ ਫਿਲਮ ਮੇਕਰਸ ਜਿਹੜੇ ਪੰਜਾਬੀ ਭਾਸ਼ਾ ਵਿੱਚ ਫਿਲਮਾਂ ਬਣਾ ਕੇ ਇੰਟਰਨੈਸ਼ਨਲ ਲੈਵਲ 'ਤੇ ਰੀਪ੍ਰਜੈਂਟ ਕਰ ਰਹੇ ਹਨ ਅਤੇ ਪੰਜਾਬੀ ਭਾਸ਼ਾ ਨੂੰ ਆਪਾਂ ਅੱਗੇ ਵਧਾਉਣ ਵਿੱਚ ਆਪਾਂ ਵੀ ਯੋਗਦਾਨ ਦੇ ਸਕਦੇ ਹਾਂ ਜਿਵੇਂ ਆਪਾਂ ਜਿੱਥੇ ਵੀ ਆਪਾਂ ਜਾਈਏ ਭਾਵੇਂ ਆਪਾਂ ਆਪਣੇ ਦੇਸ਼ 'ਚ ਹੋਈਏ ਜਾਂ ਆਪਣੇ ਦੇਸ਼ ਚੋਂ ਬਾਹਰ ਹੋਈਏ ਆਪਣੇ ਪ੍ਰਦੇਸ਼ 'ਚ ਹੋਈਏ ਆਪਣੇ ਪ੍ਰਦੇਸ਼ 'ਚੋਂ ਬਾਹਰ ਹੋਈਏ ਆਪਾਂ ਆਪਣੀ ਭਾਸ਼ਾ ਨੂੰ ਨਾ ਭੁੱਲੀਏ ਅਤੇ ਆਪਣੇ ਸੱਭਿਆਚਾਰ ਨੂੰ ਨਾ ਭੁੱਲੀਏ ਅਸੀਂ ਜਿੱਥੇ ਵੀ ਜਾਈਏ ਅਸੀਂ ਉੱਥਾਂ ਉੱਥੇ ਦੇ ਲੋਕਾਂ ਨੂੰ ਉੱਥੇ ਦੀ ਭਾਸ਼ਾ ਸਿੱਖ ਸਿੱਖਣ ਦੇ ਨਾਲ ਨਾਲ ਆਪਣੀ ਭਾਸ਼ਾ ਨੂੰ ਨਾ ਭੁੱਲੀਏ ਉਹਨਾਂ ਨੂੰ ਵੀ ਆਪਣੀ ਭਾਸ਼ਾ ਸਿਖਾਈਏ ਆਪਣਾ ਸੱਭਿਆਚਾਰ ਸਿਖਾਈਏ ਜਿਸ ਕਾਰਨ ਸਾਡੀ ਭਾਸ਼ਾ ਜੀਵਿਤ ਰਹੇ ਅਤੇ ਜਿਵੇਂ ਕਿ ਆਪਾਂ ਜਿੱਥੇ ਵੀ ਜਾਂਦੇ ਹਾਂ ਅਤੇ ਆਪਾਂ ਜ਼ਿਆਦਾਤਰ ਇੰਗਲਿਸ਼ ਭਾਸ਼ਾ ਦਾ ਵਰਤੋਂ ਕਰਦੇ ਹਾਂ ਲੇਕਿਨ ਸਾਨੂੰ ਆਪਣੀ ਭਾਸ਼ਾ ਬੋਲਣ 'ਚ ਸ਼ਰਮ ਆਉਂਦੀ ਹੈ ਇਹ ਬਹੁਤ ਗਲਤ ਗੱਲ ਸਾਡੇ ਵਿਚਾਰ ਵਿੱਚ ਹੈ ਕਿਉਂਕਿ ਆਪਣੀ ਭਾਸ਼ਾ ਨਾਲ ਜੁੜੇ ਰਹਿਣਾ ਇਹ ਸਾਡਾ ਕਰਤਵਯ ਹੈਗਾ ਸਾਡਾ ਇੱਕ ਇਹਦਾ ਇੱਕ ਅਲੱਗ ਹੀ ਮਹੱਤਵ ਹੈ ਕਿਉਂਕਿ ਸਾਡੇ ਬੱਚੇ ਜਿਹੜੇ ਆਉਣ ਵਾਲੇ ਹੋਉਂਗੇ ਸਾਡੀ ਪੀੜ੍ਹੀ ਹੋਏਗੀ ਉਹਨਾਂ ਨੂੰ ਅਗਰ ਸਾਡੀ ਭਾਸ਼ਾ ਨਹੀਂ ਪਤਾ ਹੋਏਗੀ ਸਾਡਾ ਇਤਿਹਾਸ ਨਹੀਂ ਪਤਾ ਹੋਏਗਾ ਫਿਰ ਆਪਾਂ ਸਾਡੇ ਜੀਵਿਤ ਰਹਿਣ ਦਾ ਕੋਈ ਮਤਲਬ ਨਹੀਂ ਹੈ ਇਸ ਕਰਕੇ ਸਾਨੂੰ ਆਪਣੀ ਭਾਸ਼ਾ ਨੂੰ ਬਹੁਤ ਧਿਆਨ ਨਾਲ ਸਮਝਣਾ ਚਾਹੀਦਾ ਹੈ ਅਤੇ ਦੂਜਿਆਂ ਨੂੰ ਵੀ ਸਿਖਾਉਣਾ ਚਾਹੀਦਾ ਹੈ ਧੰਨਵਾਦ